ਮੈਂ ਸਰਕਾਰੀ ਅਧਿਕਾਰੀ ਨਾਲ ਆਪਣੀ ਰਿਹਾਇਸ਼ੀ ਪਤੇ ਨੂੰ ਅਪਡੇਟ ਕੀਤਾ ਹੈ ਅਤੇ ਉਹਨਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਮੇਰਾ ਰਿਹਾਇਸ਼ੀ ਪਤਾ ਅਪਡੇਟ ਹੋ ਗਿਆ ਹੈ ਉਹਨਾਂ ਨੇ ਯਕੀਨ ਬਣਾਉਣ ਲਈ ਮੈਨੂੰ ਰਸੀਦ ਭੇਜੀ ਮੈਂ ਗ੍ਰਾਹਕ ਸੇਵਾ ਲੈਂਡਨ ਪਰਦਾਤਾ ਹੈਲਪਲਾਈਨ ਨੰਬਰ ਇੱਕ ਸੌ ਅਠਾਨਵੇਂ ਨਾਲ ਸੰਪਰਕ ਕਰਦੀ ਹਾਂ ਅਤੇ ਬੇਨਤੀ ਕਰਦੀ ਹਾਂ ਕਿ ਮੇਰੇ ਸਰਕਾਰੀ ਅਧਿਕਾਰੀਆਂ ਨੂੰ ਦਿੱਤੇ ਪਤੇ ਨਾਲ ਮੇਲ ਕਰਨ ਅਤੇ ਬਿਲਿੰਗ ਪਤੇ ਨੂੰ ਅਪਡੇਟ ਕਰਨ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਇਹ ਕੰਮ ਜਲਦ ਤੋਂ ਜਲਦ ਕੀਤਾ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਮੇਰਾ ਰਿਹਾਇਸ਼ੀ ਪਤਾ ਅਪਡੇਟ ਹੋ ਗਿਆ ਹੈ ਮੈਂ ਆਪ ਜੀ ਨੂੰ ਬੇਨਤੀ ਕਰਾਂਗੀ ਕਿ ਮੇਰੇ ਅਧਿਕਾਰੀਆਂ ਦਾ ਪਤਾ ਜਲਦ ਤੋਂ ਜਲਦ ਅਪਡੇਟ ਕਰਨ ਅਤੇ ਬਿਲਿੰਗ ਪਤੇ ਨੂੰ ਵੀ ਅਪਡੇਟ ਕੀਤਾ ਜਾਵੇ ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ